ਮੈਨੂੰ ਪੰਛੀ ਬਹੁਤ ਹੀ ਜ਼ਿਆਦਾ ਪਸੰਦ ਹੈ ਮੈਨੂੰ ਪੰਛੀਆਂ ਨੂੰ ਦੇਖਣ 'ਚ ਬਹੁਤ ਹੀ ਜ਼ਿਆਦਾ ਆਨੰਦ ਬਹੁਤ ਜ਼ਿਆਦਾ ਸਕੂਨ ਮਿਲਦਾ ਮੈਂ ਬਚਪਨ ਤੋਂ ਹੀ ਪੰਛੀ ਦੇਖਦੀ ਆ ਰਹੀ ਹਾਂ ਅਤੇ ਮੈਨੂੰ ਬਚਪਨ ਤੋਂ ਹੀ ਪੰਛੀਆਂ ਨੂੰ ਦੇਖਣ ਦਾ ਬਹੁਤ ਹੀ ਜ਼ਿਆਦਾ ਸ਼ੌਂਕ ਹੈ ਸਾਡਾ ਘਰ ਪਿੰਡ ਦੇ ਇਲਾਕੇ ਵਿੱਚ ਹੈ ਜਿੱਥੇ ਅਸਮਾਨ ਵਿੱਚ ਬਹੁਤ ਹੀ ਸਾਰੇ ਪੰਛੀ ਉੱਡਦੇ ਹਨ ਉੱਥੇ ਸਾਰੇ ਪੇੜ ਪੂੜ ਪੇੜ ਪੌਦੇ ਖੁੱਲ੍ਹੇ ਇਲਾਕੇ ਹੈ ਅਤੇ ਪੰਛੀ ਉੱਥੇ ਆਰਾਮ ਨਾਲ ਘੁੰਮਦੇ ਹਨ ਉੱਡਦੇ ਹਨ ਅਤੇ ਮੈਨੂੰ ਉਹਨਾਂ ਨੂੰ ਦੇਖ ਕੇ ਬਹੁਤ ਹੀ ਜ਼ਿਆਦਾ ਖੁਸ਼ੀ ਮਿਲਦੀ ਹੈ ਮੈਂ ਬਚਪਨ ਤੋਂ ਹੀ ਡਿਸਕਵਰੀ ਚੈਨਲਾਂ 'ਤੇ ਪੰਛੀਆਂ ਨੂੰ ਦੇਖਦੀ ਸੀ ਉਹਨਾਂ ਬਾਰੇ ਜਾਣਨ ਦੇ ਕੋਸ਼ਿਸ਼ ਕਰਦੀ ਸੀ ਉਹਨਾਂ ਬਾਰੇ ਜਾਣਨ ਬਾਰੇ ਸੋਚਦੀ ਸੀਗੀ ਹਰ ਇੱਕ ਪੰਛੀ ਨੂੰ ਦੇਖ ਕੇ ਮੇਰਾ ਦਿਲ ਕਰਦਾ ਸੀਗਾ ਕਿ ਮੈਂ ਉਹਨਾਂ ਨੂੰ ਜਾਣਾ ਉਹਨਾਂ ਦਾ ਨਾਮ ਕੀ ਹੈ ਉਹ ਸਾਰਾ ਕੁਝ ਮੈਂ ਉਹ ਹੀ ਦੇਖਦੀ ਸੀਗੀ ਫਿਰ ਥੋੜ੍ਹੀ ਜਿਹੀ ਵੱਡੀ ਹੋਈ ਮੈਂ ਸਾਰੇ ਜਿੰਨੇ ਵੀ ਪੰਛੀ ਦੇਖਦੀ ਸੀਗੀ ਜਿੱਥੇ ਵੀ ਮੈਨੂੰ ਕੋਈ ਪੰਛੀ ਦਿਖ ਜਾਂਦਾ ਸੀਗਾ ਮੈਂ ਉਹਨਾਂ ਬਾਰੇ ਗੂਗਲ ਤੋਂ ਸਰਚ ਕਰਕੇ ਉਹਨਾਂ ਦੀ ਹੋਰ ਵੱਧ ਜਾਣਕਾਰੀ ਲੈਂਦੀ ਸੀਗੀ ਜਾਣਕਾਰੀ ਲੈਂਦਿਆ ਮੈਨੂੰ ਹੋਰ ਜ਼ਿਆਦਾ ਸ਼ੌਂਕ ਪੈਂਦਾ ਸੀਗਾ ਕਿ ਮੈਂ ਇਸ ਪੰਛੀ ਬਾਰੇ ਵੀ ਹੋਰ ਜ਼ਿਆਦਾ ਜਾਣਾ ਇਸ ਪੰਛੀ ਬਾਰੇ ਵੀ ਹੋਰ ਜ਼ਿਆਦਾ ਜਾਣਾ ਮੈਨੂੰ ਬਚਪਨ ਤੋਂ ਹੀ ਬਹੁਤ ਹੀ ਜ਼ਿਆਦਾ ਪੰਛੀ ਪਸੰਦ ਹੈ ਅਤੇ ਮੈਂ ਜਦੋਂ ਵੀ ਕੋਈ ਪੰਛੀ ਦੇਖਦੀ ਹਾਂ ਉਹਨਾਂ ਨੂੰ ਹੋਰ ਜਾਣਨ ਦੇ ਉਹਨਾਂ ਦੇ ਜਾਣਕਾਰੀ ਲੈਂਦੀ ਹਾਂ ਕਈ ਐਪਸ ਤੋਂ ਜਾਂ ਕਈ ਲੋਕਾਂ ਤੋਂ ਜਿਹਨਾਂ ਨੂੰ ਪੰਛੀਆਂ ਬਾਰੇ ਪਤਾ ਕਈ ਇੱਦਾਂ ਦੀਆਂ ਥਾਵਾਂ 'ਤੇ ਵੀ ਮੈਂ ਬਹੁਤ ਹੀ ਜ਼ਿਆਦਾ ਘੁੰਮੀ ਹੋਈ ਹਾਂ ਜਿੱਥੇ ਹੋਰ ਜ਼ਿਆਦਾ ਪੰਛੀ ਹੋਣ ਜਿੱਥੇ ਪੰਛੀ ਪੰਛੀ ਹੁਣ ਮੈਂ ਹੋਰ ਵੀ ਬਹੁਤ ਜਗ੍ਹਾਵਾਂ 'ਤੇ ਘੁੰਮੀ ਹੋਈ ਹਾਂ ਪੰਛੀਆਂ ਵਾਲੀ ਜਗ੍ਹਾਵਾਂ 'ਤੇ ਉਹਨਾਂ ਦੀ ਹੋਰ ਜਾਣਕਾਰੀ ਲੈਂਦੀ ਹਾਂ ਲੋਕਾਂ ਨੂੰ ਪੁੱਛਦੀ ਹਾਂ ਕਿ ਉਹ ਪੰਛੀ ਦਾ ਨਾਮ ਕੀ ਆ ਉਹ ਕੀ ਖਾਂਦੇ ਹੈ ਕਿੱਦਾਂ ਉੱਡਦੇ ਹੈ ਕਿੱਥੇ ਰਹਿੰਦੇ ਹੈ ਸਾਰੇ ਉਹਨਾਂ ਦੀ ਜਾਣਕਾਰੀ ਮੈਂ ਲੈਂਦੀ ਹਾਂ